ਆਪਾਂ ਦੇਖਦੇ ਹਾਂ ਕਿ ਡਾਂਸ ਕਰਨਾ ਵੀ ਸਾਡੇ ਸੱਭਿਆਚਾਰਕ ਦਾ ਇੱਕ ਹਿੱਸਾ ਹੈ ਜੋ ਕਿ ਬਹੁਤ ਵਧੀਆ ਹੈ ਪਰ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਸਹੀ ਨਹੀਂ ਮੰਨਦੇ ਜਿਵੇਂ ਕਿ ਦੇਖਦੇ ਹਨ ਕਿ ਕੁਝ ਲੜਕੀਆਂ ਵਿਆਹਾਂ ਸ਼ਾਦੀਆਂ ਤੇ ਡਾਂਸ ਕਰਦੀਆਂ ਹਨ ਕੁਝ ਉਹਨਾਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਲੋਕ ਉਹਨਾਂ ਨੂੰ ਗ਼ਲਤ ਸਮਝਦੇ ਹਨ ਜਿਸ ਤਰ੍ਹਾਂ ਨਾਲ਼ ਉਹ ਆਪਣਾ ਪਹਿਰਾਵਾ ਪਾਉਂਦੇ ਹਨ ਜਾਂ ਮਨੋਰੰਜਨ ਕਰਾਉਂਦੇ ਹਨ ਕੁਝ ਲੋਕ ਉਹਨਾਂ ਨੂੰ ਗ਼ਲਤ ਨਜ਼ਰੀਏ ਨਾਲ਼ ਦੇੇਖਦੇ ਹਨ ਉਹਨਾਂ ਨੂੰ ਗ਼ਲਤ ਸਮਝਦੇ ਹਨ ਮਹਿਲਾਵਾਂ ਨੂੰ ਖਾਸ ਕਰਕੇ ਇਸ ਗੱਲ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ